ਮੋਹਾਲੀ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਸਰੋਤ ਬਹੁਤ ਹਨ ਹਰ ਤਰ੍ਹਾਂ ਦੇ ਹੈ ਤਕਰੀਬਨ ਜਿਹੜਾ ਕੋਈ ਖੇਤੀਬਾੜੀ ਨਹੀਂ ਕਰਦਾ ਅਤੇ ਪ੍ਰਾਈਵੇਟ ਕੰਮ ਵੀ ਹੈ ਫੈਕਟਰੀਆਂ ਸਾਰਾ ਕੁਛ ਹੈ ਇੱਥੇ ਚੰਡੀਗੜ੍ਹ ਨੇੜੇ ਹੋਣ ਕਰਕੇ ਰੁਜ਼ਗਾਰ ਦੇ ਸਰੋਤ ਬਹੁਤ ਹੈ ਜੀ ਇੱਥੇ ਜੇ ਸਰਕਾਰੀ ਨੌਕਰੀ ਨਹੀਂ ਕਰਦਾ ਉਹ ਖੇਤੀਬਾੜੀ ਕਰ ਰਿਹਾ ਜੀ ਆਪਣੀ ਸਰਕਾਰੀ ਨੌਕਰੀਆਂ ਨੂੰ ਤਰਜੀਹ ਇਸ ਕਰਕੇ ਦਿੰਦੇ ਹਾਂ ਬੰਦੇ ਕਿ ਤਾਂ ਕਿ ਉਹਨਾਂ ਨੂੰ ਬਾਅਦ 'ਚ ਬੁੜਾਪੇ ਦੌਰਾਨ ਪੈਨਸ਼ਨ ਦਾ ਲਾਭ ਲਿਆ ਜਾ ਸਕੇ ਅਤੇ ਆਪਣੇ ਸਾਡੇ ਜ਼ਿਲ੍ਹੇ 'ਚ ਬੇਰੁਜ਼ਗਾਰੀ ਇੰਨੀ ਹੈ ਨਹੀਂ ਤਕਰੀਬਨ ਸਭ ਕੋਲ ਕੰਮ ਹੈ ਜੀ ਆਪਣੇ ਆਪਣੇ ਸਾਰਿਆਂ ਦੀ ਸੈਟਿੰਗ ਹੈ ਜੀ ਕੰਮ ਦੀ ਸਾਡੇ ਤਾਂ ਮੋਹਾਲੀ ਜ਼ਿਲ੍ਹੇ 'ਚ ਰੁਜ਼ਗਾਰ ਦੇ ਸਰੋਤ ਬਹੁਤ ਹੈ ਜੀ